ਹੈਲੋ

ਆਪ ਕੌਫੀ ਸ਼ੋਪ ਸੇ ਬਾਤ ਕਰ ਰਹੇ ਹੋ ਮੈਡਮ ਸਾਨੂੰ ਓਕੇ ਮੈਡਮ ਮੈਨੂੰ ਨਾ ਮਤਲਬ ਪੁੱਛਣਾ ਸੀ ਤੁਹਾਡੀ ਸ਼ੋਪ 'ਤੇ ਕਿਹੜੀ ਕਿਹੜੀ ਵਿਰਾਈਟੀਜ ਦੀਆਂ ਟੀ ਤੁਸੀਂ ਦੇ ਸਕਦੇ ਹੋ ਅਤੇ ਕੌਫੀ ਕਿਹੜੇ ਕਿਹੜੇ ਹੈਗੀਆਂ ਨੇ ਕਿਹੜੇ ਕਿਹੜੇ ਉਨ੍ਹਾਂ 'ਚ ਫਲੇਵਰ ਨੇ ਹਾਂਜੀ ਮੈਮ ਹਾਂਜੀ ਸਹੀ ਹੈ ਓਕੇ ਓਕੇ ਮੈਮ ਤੁਸੀਂ ਜਿਵੇਂ ਆਪਣੀ ਹੈਲਥ ਦੇ ਰਿਲੇਟਡ ਕਿਹੜੀ ਆਪਣੇ ਕੋਲ ਵਧੀਆ ਜਿਹੜੀ ਟੀ ਹੈ ਆਪਾਂ ਪੀ ਸਕਦੇ ਹਾਂ ਜਿਹਦੇ ਨਾਲ ਆਪਾਂ ਨੂੰ ਕੋਈ ਸਾਈਡ ਇਫੈਕਟ ਵੀ ਨਾ ਹੋਵੇ ਅਤੇ ਥੋੜ੍ਹਾ ਵਧੀਆ ਡਾਈਟ ਵਰਤੋਂ ਕਿਹੜੀ ਚੀਜ ਵਰਤੋਂ ਕਿਹੜੀ ਟੀ ਵਰਤ ਸਕਦੇ ਹਾਂ ਓਕੇ ਠੀਕ ਹੈ ਲਿਪਟਨ ਗ੍ਰੀਨ ਟੀ ਆਪਣੇ ਕੋਲ ਹੈਗੀ ਹੈ ਠੀਕ ਹੈ ਮ ਤੁਸੀਂ ਮੈਮ ਇਨ੍ਹਾਂ ਦੇ ਪ੍ਰਾਈਜ ਦੱਸ ਸਕਦੇ ਹੋ ਲਿਪਟਨ ਗ੍ਰੀਨ ਟੀ ਦੇ ਕੀ ਹੈ ਓਕੇ ਅਤੇ ਕੌਫੀ ਤੁਸੀਂ ਹੌਟ ਕੌਫੀ ਨੈਸਲੇ ਵਾਲੀ ਦੱਸ ਦਿਉ ਓਕੇ ਠੀਕ ਹੈ ਮੈਮ ਤੁਹਾਡੀ ਸ਼ੋਪ ਦਾ ਟਾਈਮਿੰਗ ਕੀ ਹੈ ਕਦੋਂ ਤੱਕ ਤੁਸੀਂ ਮਤਲਬ ਆਪਣੀ ਸ਼ੋਪ 'ਤੇ ਰਹਿੰਦੇ ਹੋ ਕਦੋਂ ਤੱਕ ਸਾਡੀ ਸੇਵਾ ਵਿੱਚ ਰਹਿੰਦੇ ਹੋ ਹਾਜ਼ਰ ਓਕੇ ਅਤੇ ਮੈਮ ਕੋਲਡ ਕੌਫੀ ਕੀ ਪ੍ਰਾਈਜ ਹੈ

ਠੀਕ ਹੈ ਮੈਮ ਤੁਸੀਂ ਮਤਲਬ ਆਪਣੀ ਸ਼ੋਪ ਦਾ ਮੈਨਿਊ ਜਿਹੜਾ ਹੈ ਔਨਲਾਈਨ ਸਾਨੂੰ ਮਿਲ ਸਕਦਾ ਹੈ ਓਕੇ ਮੈਮ ਥੈਂਕ ਯੂ ਮੈਮ